ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ ਜਿੰਨਾਂ ਵਿੱਚ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਆ ਰਹੀ ਕਿ ਜਿਹੜੇ ਪ੍ਰਾਈਵੇਟ ਸਕੂਲ ਹਨ ਉਹਨਾਂ ਦੀ ਧੱਕੇਸ਼ਾਹੀ ਨੂੰ ਸਹਿਣ ਕਰਨਾ ਪੈਂਦਾ ਹੈ ਉਹਨਾਂ ਦੀਆਂ ਸਭ ਤੋਂ ਵੱਡੀਆਂ ਮੋਟੀਆਂ ਫੀਸਾਂ ਮਾਂ ਬਾਪ ਨੂੰ ਪੇ ਕਰਨੀਆਂ ਪੈਂਦੀਆਂ ਹਨ ਇਸ ਤੋਂ ਇਲਾਵਾ ਜਿਹੜੇ ਉਹਨਾਂ ਨੂੰ ਫੰਡਸ ਦੇਣੇ ਪੈਂਦੇ ਹਨ ਬਿਲਡਿੰਗ ਦੇ ਨਾਮ 'ਤੇ ਫੰਡਸ ਹੈਗੇ ਆ ਜਾਂ ਫਿਰ ਜਿਹੜੇ ਉਹਨਾਂ ਦੇ ਫ਼ਾ ਫਾਈਨ ਲਗਾ ਦਿੰਦੇ ਹਨ ਬੱਚਿਆਂ ਨੂੰ ਉਹ ਫਾਈਨ ਬੱਚੇ ਨਹੀਂ ਭਰਦੇ ਉਹਨਾਂ ਦੇ ਮਾਂ ਬਾਪ ਭਰਦੇ ਹਨ ਸੋ ਇਕਨੋਮਿਕਲੀ ਉਹਨਾਂ ਦੀ ਜੇਬ 'ਤੇ ਜਿਹੜਾ ਇੱਕ ਵੱਡਾ ਡਾਕਾ ਵੱਜਦਾ ਹੈ ਮਾਂ ਬਾਪ ਦੀ ਜੇਬ 'ਤੇ ਉਹ ਇੱਕ ਮੁੱਖ ਚੁਣੌਤੀ ਹੈ ਦੂਜੇ ਨੰਬਰ 'ਤੇ ਸਾਡੇ ਕੋਲ ਜਿਹੜੀ ਸਿੱਖਿਆ ਪ੍ਰਣਾਲੀ ਦੇ ਵਿੱਚ ਜਿਹੜਾ ਸਿਲੇਬਸ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਤਾਂ ਜਾਂਦਾ ਹੈ ਪਰ ਉਹਨਾਂ ਨੂੰ ਸਿਖਾਇਆ ਨਹੀਂ ਜਾਂਦਾ ਮੰਨ ਲਓ ਕੋਈ ਵੀ ਅਸੀਂ ਕੋਰਸ ਲੈਂਦੇ ਹਾਂ ਕੋਈ ਵੀ ਅਸੀਂ ਕਿ ਕਿੱਤਾ ਮੁਖੀ ਕੋਰਸ ਲੈਂਦੇ ਹਾਂ ਤਾਂ ਉਹਦੇ ਵਿੱਚ ਉਹਨਾਂ ਨੂੰ ਸਿਖਾ ਤਾਂ ਦਿੱਤਾ ਜਾਂਦਾ ਹੈ ਵੀ ਇਸ ਤਰ੍ਹਾਂ ਕਰਨਾ ਹੈ ਪਰ ਉਹਨਾਂ ਨੂੰ ਕਿੱਦਾਂ ਕਰਨਾ ਹੈ ਉਹਨਾਂ ਨੂੰ ਪੜ੍ਹਾਇਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਦਿਮਾਗਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਵੀ ਇਹ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਸੋ ਇਹ ਵੀ ਇੱਕ ਵੱਡੀ ਮੁੱਖ ਚੁਣੌਤੀ ਹੈ ਤੀਜੇ ਨੰਬਰ 'ਤੇ ਜਿਹੜਾ ਸਿਲੇਬਸ ਹੈ ਉਹ ਬਹੁਤ ਜ਼ਿਆਦਾ ਪੁਰਾਣਾ ਹੈ ਉਹੀ ਸਿਲੇਬਸ ਤੋਤੇ ਵਾਂਗ ਰਟਾਇਆ ਜਾਂਦਾ ਹੈ ਸ਼ਾਇਦ ਵੀਹ ਤੀਹ ਸਾਲ ਪੁਰਾਣੀਆਂ ਉਹੀ ਕਹਾਣੀਆਂ ਉਹੀ ਸਿਲੇਬਸ ਉਹੀ ਉਸ ਨਵੀਨੀਕਰਨ ਨੇ ਕੀਤਾ ਜਾਂਦਾ ਔਰ ਨਵੀਨੀਕਰਨ ਵੀ ਜਿਹੜਾ ਹੈਗਾ ਉਹ ਕਿੱਤਾ ਮੁਖੀ ਜਿਹੜੀ ਪੜ੍ਹਾਈ ਹੈ ਗਿਆਨ ਹੈ ਉਹ ਦੇਣਾ ਚਾਹੀਦਾ ਤਾਂ ਕਿ ਜਦੋਂ ਉਹ ਆਪਣੀ ਵਿੱਦਿਆ ਖਤਮ ਕਰਕੇ ਉਸ ਸੰਸਥਾ ਤੋਂ ਬਾਹਰ ਆਉਣ ਤਾਂ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ